ਜਲੰਧਰ ਬਾਈਪਾਸ ਗਿੱਲ ਚੌਂਕ ਆਲਮਗੀਰ ਜਲੰਧਰ ਬਾਈਪਾਸ ਤੋਂ ਲੈ ਕੇ ਸਮਰਾਲਾ ਚੌਂਕ ਸ਼ੇਰਪੁਰ ਚੌਂਕ ਢੋਲੇਵਾਲ ਸਾਊਥ ਸਿਟੀ ਭਾਰਤ ਨਗਰ ਬਸਤੀ ਜੋਧੇਵਾਲ ਸਮ ਸ਼ਿਵਪੁਰੀ ਜੱਸੀਆਂ ਬੜੀ ਹੈਬੋਵਾਲ ਛੋਟੀ ਹੈਬੋਵਾਲ